ਸਾਡੇ ਖੇਤਰ ਵਿੱਚ ਕਾਰੋਬਾਰ ਇਸ ਤਰ੍ਹਾਂ ਦੇ ਹਨ ਸੈਕਲਾਂ ਨੂੰ ਪੈਨਚਰ ਲਗਾਉਣੇ ਮੋਟਰਸੈਕਲ ਰਿਪੇਅਰਿੰਗ ਕਰਨੇ ਗੱਡੀਆਂ ਦੇ ਕਾਰੋਬਾਰ ਕਰਨੇ ਫਸਲਾਂ ਨੂੰ ਸਟੋਰ ਕਰਨਾ ਆਦਿ ਬਿਜ਼ਨਸ ਚਲ ਰਹੇ ਹਨ ਬਾਕੀ ਕੁਛ ਬਿਜ਼ਨਸ ਦੁਕਾਨਾਂ ਦੇ ਖੀ ਖੇਤਰ ਵਿੱਚ ਚੀਜ਼ਾਂ ਦੀ ਮੰਗ ਨਾਲ ਵੀ ਹੈ ਜੋ ਕਿ ਕਰਿਆਨਾ ਸ਼ੌਪ ਕਰੋਕਰੀ ਸ਼ੌਪ ਠੀਕ ਹੈ ਜੀ ਸਬਜ਼ੀ ਸ਼ੌਪ ਆਦਿ ਸਭ ਜ਼ਰੂਰੀ ਹਨ ਫਲ ਫਰੂਟ ਆਦਿ ਪਟਰੋਲ ਪੰਪ ਹਰ ਸ਼ੈਅ ਹੋਣੀ ਬਹੁਤ ਜ਼ਰੂਰੀ ਹੈ ਧੰਨਵਾਦ